ਇੱਕ ਖੂਹ ਵਿੱਚੋਂ ਪਾਣੀ ਕੱਢਣ ਲਈ ਕਈ ਤਰੀਕੇ ਹੋ ਸਕਦੇ ਹਨ ਸਭ ਤੋਂ ਸੌਖਾ ਤਰੀਕਾ ਤਾਂ ਹੋਵੇਗਾ ਤੇ ਇੱਕ ਰੱਸੀ ਜਾਂ ਬਾਲਟੀ ਵਰਗੀ ਕੋਈ ਚੀਜ਼ ਹੋਏ ਅਤੇ ਅਸੀਂ ਉਹਨੂੰ ਅੰਦਰ ਲਟਕਾ ਕੇ ਉਹਦੇ ਵਿੱਚੋਂ ਪਾਣੀ ਭਰ ਕੇ ਬਾਹਰ ਕੱਢ ਲਿਆ ਜਾਵੇ ਸੋ ਜਿੱਦਾਂ ਕਿ ਕੁਸ਼ਚਨ ਵਿੱਚ ਲਿਖਿਆ ਹੈ ਕਿ ਕੋਈ ਇਲੈਕਟਰਿਕ ਮੋਟਰ ਦੀ ਵਰਤੋਂ ਕਿਵੇਂ ਕਰ ਸਕਦਾ ਹੈ ਤਾਂ ਉਹ ਫਿਰ ਇਹ ਹੋਵੇਗਾ ਕਿ ਸਾਨੂੰ ਇੱਕ ਪਾਈਪ ਦੀ ਜ਼ਰੂਰਤ ਹੋਵੇਗੀ ਜਿਹੜੀ ਪਾਈਪ ਪਾਣੀ ਅਤੇ ਖੂਹ ਦੇ ਥੱਲੇ ਤੱਕ ਡੁਬਾ ਦਿੱਤੀ ਜਾਵੇਗੀ ਅੰਦਰ ਨੂੰ ਜਿਹੜਾ ਪਾਈਪ ਦਾ ਮੂੰਹ ਜਿਹੜਾ ਬਾਹਰ ਹੋਵੇਗਾ ਉਹ ਆਪਣਾ ਆਪਾਂ ਨੂੰ ਮੋਟਰ ਨਾਲ ਲਗਾਉਣਾ ਪਵੇਗਾ ਟੁੱਲੂ ਪੰਪ ਕਹਿੰਦੇ ਜਿਹਨੂੰ ਲੋਕਲ ਜਾਂ ਕੋਈ ਵੀ ਟੁੱਲੂ ਪੰਪ ਹੀ ਹੋਵੇਗਾ ਜਾਂ ਇੱਦਾਂ ਦੀ ਕਈ ਮੋਟਰਸ ਆਉਂਦੀਆਂ ਨੇ ਉਹ ਪਾਈਪ ਚੋਂ ਫਿਰ ਪਾਣੀ ਖਿੱਚਣਾ ਸ਼ੁਰੂ ਕਰੇਗੀ ਔਰ ਪਾਣੀ ਉੱਪਰ ਕਿਤੇ ਆ ਇੱਕ ਬਰਤਨ ਵਿੱਚ ਬਾਲਟੀ ਵਿੱਚ ਇਕੱਠਾ ਕਰ ਸਕਦੇ ਹਾਂ ਤੀਸਰੀ ਸਬਮਰਸੀਬਲ ਮੋਟਰਾਂ ਵੀ ਆਉਂਦੀਆਂ ਹਨ ਜਿਹੜੀਆਂ ਪਾਣੀ ਦੇ ਵਿੱਚ ਹੁੰਦੀਆਂ ਹਨ ਬਟ ਖੂਹ ਚੋਂ ਕੱਢਣ ਲਈ ਨਹੀਂ ਉਹ ਮੁਸ਼ਕਿਲ ਹੋ ਜਾਵੇਗਾ ਮੈਨੂੰ ਲੱਗਦਾ ਇਹ ਹੀ ਦੋ ਥੋੜ੍ਹੀਆਂ ਸੌਖੀਆਂ ਉਦਾਹਰਣਾਂ ਹੋ ਸਕਦੀਆਂ ਹਨ